ਇੱਕੀ ਅਗਸਤ ਦੋ ਹਜ਼ਾਰ ਪੰਜ ਇੱਕ ਫਰਵਰੀ ਉੱਨੀ ਸੌ ਅਠਾਨਵੇਂ ਚਾਰ ਮਈ ਦੋ ਹਜ਼ਾਰ ਇੱਕੀ ਸੋਲ੍ਹਾਂ ਮਈ ਦੋ ਹਜ਼ਾਰ ਚਾਰ ਤੇਰ੍ਹਾਂ ਜੂਨ ਉੱਨੀ ਸੌ ਨੜਿਨਵੇਂ